ਸੂਟ ਤਾਂ ਮੈਂ ਬਹੁਤ ਵਧੀਆ ਸੀਂਦੀ ਹਾਂ ਸਾਰੇ ਮੇਰੇ ਗਾਹਕ ਬਹੁਤ ਖੁਸ਼ ਹੁੰਦੇ ਹਨ ਪਰ ਉਹਨਾਂ ਨੇ ਕਿਹਾ ਹੈ ਕਿ ਜੇ ਤੁਸੀਂ ਕੱਪੜਾ ਵੀ ਆਪਣੇ ਕੋਲ ਰੱਖ ਕੇ ਅਤੇ ਆਪਣੇ ਕੋਲੋਂ ਰ ਚੁੰਨੀਆਂ ਚਾਨੀਆਂ ਲਗਾ ਕੇ ਦਉਗੇ ਤਾਂ ਤੁਹਾਡਾ ਹੋਰ ਵੀ ਵਧੀਆ ਹੋ ਜਾਏਗਾ ਅਤੇ ਲੋਕੀ ਮੇਰੇ ਸੂਟਾਂ ਨੂੰ ਬਹੁਤ ਹੀ ਪਸੰਦ ਕਰਦੇ ਹਨ ਉਹ ਮੈਨੂੰ ਇੱਕ ਸੂਟ ਤੋਂ ਇਲਾਵਾ ਮੇਰੇ ਹੋਰ ਵੀ ਗਾਹਕ ਲੈ ਕੇ ਆਉਂਦੇ ਹਨ ਧੰਨਵਾਦ